ਅਤੇ ਗਲੋਬਲ ਮੁੱਦਿਆਂ ਦੇ ਉੱਤੇ ਸਰਕਾਰ ਜਿਹੜੀ ਆ ਬਹੁਤ ਅੱਗੇ ਤੱਕ ਵੱਧ ਚੁੱਕੀ ਹੈ ਠੀਕ ਹੈ ਇਹਦੇ ਲਈ ਉਹਨਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਜਿਹੜੀ ਜੋ ਕਿਸਾਨਾਂ ਲਈ ਕਿਸਾਨਾਂ ਜਿਹੜੇ ਜ਼ਮੀਨ ਲੈਂਦੇ ਨੇ ਠੀਕ ਹੈ ਉਹਨਾਂ ਨੂੰ ਉਹਨਾਂ ਦੇ ਉੱਤੇ ਕੋਈ ਟੈਕਸ ਹੀ ਨਹੀਂ ਦੇਣਾ ਪੈਂਦਾ ਠੀਕ ਹੈ ਅਤੇ ਉਹਨਾਂ ਨੂੰ ਜਿਹੜਾ ਉਹ ਲੋਨ ਲੈਂਦੇ ਨੇ ਬੈਂਕ ਤੋਂ ਉਹ ਉਹਨਾਂ ਨੂੰ ਸਮੇਂ ਸਿਰ ਵਾਪਿਸ ਦੇਣਾ ਪੈਂਦਾ ਠੀਕ ਹੈ ਅਤੇ ਉਹ ਵੀ ਘੱਟ ਇੰਟਰਸਟ 'ਤੇ ਅਤੇ ਦੂਜੇ ਪਾਸੇ ਆ ਗਿਆ ਸਾਡੀ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਲਈ ਸਰਕਾਰ ਨੇ ਬਹੁਤ ਵੱਡੇ ਵੱਡੇ ਮਤਲਬ ਕਿ ਕਦਮ ਚੁੱਕੇ ਨੇ ਅੱਗੇ ਅੱਗੇ ਤਾਂ ਇਹ ਨਹੀਂ ਆ ਕਿ ਸਾਡੀ ਇੱਕ ਸਰਕਾਰ ਨੇ ਚੁੱਕੇ ਆ ਅਤੇ ਜਿਹੜੀ ਅੱਗੇ ਅੱਗੇ ਸਰਕਾਰਾਂ ਬਣਦੀਆਂ ਜਾ ਰਹੀਆਂ ਨੇ ਉਹਨਾਂ ਨੇ ਕੀ ਕਹਿੰਦੇ ਆ ਅੱਗੇ ਅੱਗੇ ਹੀ ਕਦਮ ਚੁੱਕੇ ਨੇ ਠੀਕ ਹੈ ਜੋ ਸਾਡੀ ਹੁਣ ਵਾਲੀ ਸਰਕਾਰ ਹੈ ਜੋ ਸਾਡੀ ਲੇਟੈਸਟ ਬਣੀ ਸਰਕਾਰ ਬਣੀ ਆ ਉਹਨਾਂ ਨੇ ਬਹੁਤ ਵੱ ਵੱਡੇ ਕਦਮ ਚੁੱਕੇ ਨੇ ਜਿੱਦਾਂ ਕਿ ਉਹਨਾਂ ਨੇ ਕਿਹਾ ਹੈ ਕਿ ਖੇਤਾਂ ਦੇ ਵਿੱਚ ਗਲੋਬਲ ਵਾਰਮਿੰਗ ਲਈ ਵੱਧ ਤੋਂ ਵੱਧ ਪੇੜ ਉਗਾਓ ਜਾਂ ਕੀਟਨਾਸ਼ਕ ਦਵਾਈਆਂ ਨੂੰ ਘੱਟ ਯੂਜ ਕਰੋ ਖੇਤਾਂ ਦੇ ਵਿੱਚ ਠੀਕ ਹੈ ਅਤੇ ਉਹਨਾਂ ਨੂੰ ਉਹ ਹੀ ਦੀ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਵਾ ਕਿ ਕੀ ਕਹਿੰਦੇ ਆ ਜੋ ਤੁਸੀਂ ਆਪਣਾ ਖਾਦ ਬਣਾਉਂਦੇ ਹੋ ਉਹ ਘਰ ਬਣਾਓ ਜਿੱਦਾਂ ਘਰ ਦੇ ਵਿੱਚ ਕੋਈ ਖਰਾਬ ਫਲ ਸਬਜ਼ੀਆਂ ਹੈਗੀਆਂ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਆ ਖਾਦ ਦੇ ਵਿੱਚ ਯੂਜ ਕਰੋ ਅਤੇ ਉਹਨਾਂ ਦੇ ਵਿੱਚੋਂ ਹੀ ਕੀ ਕਹਿੰਦੇ ਆ ਤੁਸੀਂ ਆਪਣੇ ਬੀਜ ਲਓ ਉਹ 'ਚੋਂ ਨਰਸਰੀ 'ਚੋਂ ਅਤੇ ਉਹਨਾਂ ਨੂੰ ਆਪਣੇ ਕੀ ਕਹਿੰਦੇ ਆ ਫਲ ਸਬਜੀਆਂ ਉਹਨਾਂ ਤੋਂ ਉਗਾਓ ਜੋ ਕਿ ਘਰ ਦੀ ਬਣੀ ਹੋਈ ਖਾਦ ਦੇ ਵਿੱਚ ਹੀ ਤੁਸੀਂ ਉਗਾਓ ਫਲ ਸਬਜੀਆਂ ਅਤੇ ਜਿਨ੍ਹਾਂ ਦੇ ਵਿੱਚ ਕੀ ਕਹਿੰਦੇ ਆ ਤੁਹਾਨੂੰ ਖੇਤਾਂ ਦੇ ਵਿੱਚ ਕੀ ਕਹਿੰਦੇ ਆ ਜੋ ਕੀਟਨਾਸ਼ਕ ਦਵਾਈਆਂ ਅੱਜ ਕੱਲ੍ਹ ਛਿੜਕਦੇ ਆ ਉਹਨਾਂ ਨੂੰ ਉਸ ਲਈ ਕੀ ਕਹਿੰਦੇ ਆ ਮਨਾ ਕਰੋ